ਹੈਲੋ ਹਾਂਜੀ ਕ੍ਰੀਏਟਿਵ ਫੂਡ ਤੋਂ ਬੋਲ ਰਹੇ ਹਾਂਜੀ ਮੈਂ ਵਿਕਰਮ ਤਿਵਾਰੀ ਬੋਲ ਰਿਹਾ ਪ੍ਰੇਮ ਨਗਰ ਤੋਂ ਹਾਂਜੀ ਹਾਂਜੀ ਉਹ ਮੁੰਡੇ ਨੂੰ ਮੈਂ ਔਡਰ ਦਿੱਤਾ ਸੀਗਾ ਤੁਹਾਡੇ ਨੂੰ ਇੱਕ ਉਹਦੇ ਵਿੱਚ ਪਹਿਲਾਂ ਤਾਂ ਕੁਛ ਕੁ ਚੀਜ਼ਾਂ ਮੈਂ ਹੋਰ ਐਡ ਕਰਵਾਉਣੀਆ ਹੈ ਹਾਂਜੀ ਪਹਿਲਾਂ ਮੈਂ ਔਡਰ ਦਿੱਤਾ ਸੀਗਾ ਪੀਜ਼ਾ ਨਿਊਡਲਸ ਔਰ ਬਰਗਰ ਦਾ ਇੱਦਾਂ ਕਰਿਉ ਉਹਦੇ ਵਿੱਚ ਨਾ ਇੱਕ ਉਹ ਐਡ ਕਰ ਦਿਉ ਪਲੇਨ ਪੀਜ਼ਾ ਅਤੇ ਇੱਕ ਮਸ਼ਰੂਮ ਨਹੀਂ ਮਸ਼ਰੂਮ ਨਹੀਂ ਸੌਰੀ ਮਨਚੁਰੀਅਨ ਗ੍ਰੇਵੀ ਠੀਕ ਹੈ ਜੀ ਅਤੇ ਬਾਕੀ ਇੱਕ ਹੋਰ ਮੈਂ ਤੁਹਾਨੂੰ ਰਿਕੁਐਸਟ ਕਰਨੀ ਸੀਗੀ ਮੈਂ ਉਸ ਟਾਈਮ ਕਿਹਾ ਸੀਗਾ ਕਿ ਮੈਂ ਔਨਲਾਈਨ ਪੇਮੈਂਟ ਕਰੂੰਗਾ ਲੇਕਿਨ ਮੇਰੇ ਜਿਹੜੇ ਗੂਗਲ ਪੇ ਹੈ ਉਹਦੇ ਵਿੱਚ ਨਾ ਸਰਵਰ ਦਾ ਕੋਈ ਇਸ਼ੂ ਚੱਲ ਰਿਹਾ ਹਾਂਜੀ ਹਾਂਜੀ ਹਾਂਜੀ ਜਾਣਦੇ ਹੋ ਤੁਸੀਂ ਮੈਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਔਡਰ ਕੀਤਾ ਵਾ ਹੈ ਹਾਂਜੀ ਹਾਂਜੀ ਹਾਂਜੀ ਉਹ ਬੱਚੇ ਸਾਡੇ ਖਾਂਦੇ ਹੀ ਤੁਹਾਡੇ ਤੋਂ ਦੁਕਾਨ ਦਾ ਹੈ ਤੁਸੀਂ ਇਹ ਜਾਣਦੇ ਹੋ ਚੰਗੀ ਤਰ੍ਹਾਂ ਸਾਨੂੰ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਇੱਦਾਂ ਕਰਿਉ ਕਿ ਇਹ ਔਡਰ ਦੇ ਦਿਉ ਨਾਲੇ ਮੁੰਡੇ ਨੂੰ ਸਮਝਾ ਦਿਉ ਕਿ ਤੁਸੀਂ ਹੁਣ ਉਹਨੂੰ ਕਿਹਾ ਹੋਣਾ ਕਿ ਕੈਸ਼ ਉਹ ਦਊਗੇ ਔਨਲਾਈਨ ਪੇਮੈਂਟ ਕਰੂੰਗੇ ਲੇਕਿਨ ਹੁਣ ਉਹਦੇ ਕਰਕੇ ਮੈਂ ਔਨਲਾਈਨ ਪੇਮੈਂਟ ਨਹੀਂ ਕਰ ਪਾਉਣਾ ਤਾਂ ਮੈਂ ਤੁਹਾਨੂੰ ਨਾ ਮੁੰਡਾ ਆਊਂਗਾ ਉਹਨੂੰ ਕੈਸ਼ ਦੇ ਦੂਗਾ ਪੇਮੈਂਟ ਕੋਈ ਇਸ਼ੂ ਤਾਂ ਨਹੀਂ ਇਹਦੇ ਵਿੱਚ ਠੀਕ ਹੈ ਚਲੋ ਠੀਕ ਹੈ ਫਿਰ ਠੀਕ ਹੈ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਠੀਕ ਹੈ ਪਜਾ ਦਿਉ ਥੋੜ੍ਹਾ ਟਾਈਮ ਨਾਲ਼ ਠੀਕ ਹੈ ਜੀ ਸ਼ੁਕਰੀਆ